ਦੌੜਨ ਦੇ ਸਾਡੇ ਸਰੀਰ ਲਈ ਬਹੁਤ ਫਾਇਦੇ ਹਨ ਸਾਨੂੰ ਹਮੇਸ਼ਾਂ ਹੀ ਕੱਚੇ ਵਿੱਚ ਦੌੜਨਾ ਚਾਹੀਦਾ ਹੈ ਜੇ ਅਸੀਂ ਪੱਕੇ ਵਿੱਚ ਸੜਕ ਉੱਤੇ ਦੌੜਾਂਗੇ ਤਾਂ ਸਾਡੀਆਂ ਲੱਤਾਂ ਵੀ ਜ਼ਿਆਦਾ ਦੁੱਖਦੀਆਂ ਹਨ ਅਤੇ ਲੱਤਾਂ ਵਿੱਚ ਬਲ਼ ਵੀ ਪੈ ਸਕਦਾ ਹੈ ਅਤੇ ਇਸ ਕਰਕੇ ਸਾਨੂੰ ਹਮੇਸ਼ਾਂ ਗਰਾਉਂਡ ਵਿੱਚ ਜਾਂ ਘਾਹ ਉੱਤੇ ਦੌੜਨਾ ਚਾਹੀਦਾ ਹੈ ਅਤੇ ਘਾਹ ਉੱਤੇ ਜਾਂ ਤਾਂ ਨੰਗੇ ਪੈਰ ਦੌੜੋ ਜਾਂ ਤਾਂ ਫਿਰ ਸੂਜ਼ ਪਾ ਕੇ ਦੌੜਨਾ ਚਾਹੀਦਾ ਹੈ ਇਸ ਵਿੱਚ ਸਾਨੂੰ ਆਹ ਫਾਇਦਾ ਹੈ ਵੀ ਜਦੋਂ ਅਸੀਂ ਦੌੜਦੇ ਹਾਂ ਸਾਡੇ ਭੱਜਣ ਰਾਹੀਂ ਸਾਡੇ ਸਰੀਰ ਵਿੱਚੋਂ ਪਸੀਨਾ ਬਾਹਰ ਨਿਕਲਦਾ ਹੈ ਅਤੇ ਜੋ ਵੀ ਸਾਡੇ ਸਰੀਰ ਵਿੱਚ ਬਿਮਾਰੀਆਂ ਹੁੰਦੀਆਂ ਹਨ ਉਹ ਪਸੀਨੇ ਰਾਹੀਂ ਬਾਹਰ ਨਿਕਲਦੀਆਂ ਹਨ ਅਤੇ ਜਦੋਂ ਅਸੀਂ ਭੱਜਦੇ ਹਾਂ ਅਤੇ ਸਾਡਾ ਸਰੀਰ ਵੀ ਲਚਕੀਲਾ ਰਹਿੰਦਾ ਹੈ ਅਤੇ ਤੰਦਰੁਸਤ ਰਹਿੰਦਾ ਹੈ ਅਤੇ ਜਦੋਂ ਅਸੀਂ ਤੰਦਰੁਸਤ ਰਹਿੰਦੇ ਹਾਂ ਅਤੇ ਅਸੀਂ ਕੋਈ ਵੀ ਕੰਮ ਕਰ ਸਕਦੇ ਹਾਂ ਅਤੇ ਸਾਡੇ ਸਰੀਰ ਵਿੱਚੋਂ ਫੁਰਤੀਲਾਪਨ ਹੋਵੇਗਾ ਅਤੇ ਅਸੀਂ ਕਿਸੇ ਦੀ ਵੀ ਹੈਲਪ ਕਰ ਸਕਦੇ ਹਾਂ ਅਤੇ ਅਸੀਂ ਕੋਈ ਵੀ ਕੰਮ ਕਰ ਸਕਦੇ ਹਾਂ ਅਤੇ ਅਸੀਂ ਵਜਨ ਵੀ ਕੁਝ ਵੀ ਚੱਕ ਸਕਦੇ ਹਾਂ ਅਤੇ ਜਦੋਂ ਅਸੀਂ ਗਰਾਊਂਡ ਵਿੱਚ ਜਾ ਕੇ ਦੌੜਦੇ ਹਾਂ ਅਤੇ ਸਾਡੇ ਇਸ ਸਰੀਰ ਵਿੱਚ ਰਫਤਾਰ ਵੀ ਰਹਿੰਦੀ ਹੈ ਅਤੇ ਜਿਸ ਕਾਰਨ ਕੀ ਸਾਡੇ ਜ ਸਰੀਰ ਨੂੰ ਬਹੁਤ ਫਾਇਦਾ ਹੁੰਦਾ ਏ ਆਹ ਚੀਜ਼ਾਂ ਦਾ ਅਤੇ ਸਾਨੂੰ ਜਦੋਂ ਅਸੀਂ ਕੋਈ ਵੀ ਕੰਮ ਕਰਨਾ ਹੈ ਤਾਂ ਸਾਨੂੰ ਭੱਜਣ ਦੌੜਨ ਦਾ ਅਸੀਂ ਕੋਈ ਵੀ ਕੰਮ ਕਰ ਸਕਦੇ ਹਾਂ ਦੌੜਨ ਨਾਲ ਅਤੇ ਇਸ ਕਰਕੇ ਸਾਨੂੰ ਹਮੇਸ਼ਾਂ ਮਤਲਬ ਵੀ ਭੱਜਣਾ ਚਾਹੀਦਾ ਹੈ ਸਾਨੂੰ ਕੱਚੇ ਵਿੱਚ ਹੀ ਜ਼ਿਆਦਾ ਦੌੜਨਾ ਚਾਹੀਦਾ ਹੈ ਅਤੇ ਸਾਡੇ ਜੋ ਵੀ ਸਰੀਰ ਦੇ ਤੰ ਅੰਗ ਹਨ ਉਹ ਤੰਦਰੁਸਤ ਰਹਿੰਦੇ ਹਨ ਭੱਜਣ ਰਾਹੀਂ ਉਹਨਾਂ ਵਿੱਚ ਉਹਨਾਂ ਵਿੱਚ ਤੰਦਰੁਸਤੀ ਬਣੀ ਰਹਿੰਦੀ ਹੈ ਅਤੇ ਜਿਸ ਕਾਰਨ ਸਾਨੂੰ ਹਮੇਸ਼ਾਂ ਹੀ ਸਵੇਰ ਦੇ ਟਾਈਮ ਜ਼ਿਆਦਾ ਦੌੜਨਾ ਚਾਹੀਦਾ ਹੈ ਅਤੇ ਸਾਨੂੰ ਧੁੱਪ ਵਿੱਚ ਜ਼ਿਆਦਾ ਨਹੀਂ ਦੌੜਨਾ ਚਾਹੀਦਾ ਹੈ ਧੁੱਪ ਵਿੱਚ ਸਾਡਾ ਪਸੀਨਾ ਜ਼ਿਆਦਾ ਨਿਕਲਦਾ ਹੈ ਜਿਸ ਕਾਰਨ ਸਾਡੇ ਸਰੀਰ ਵਿੱਚ ਪਾਣੀ ਦੀ ਕਮੀ ਆਉਂਦੀ ਹੈ ਅਤੇ ਸਾਨੂੰ ਸਵੇਰ ਦੇ ਸਮੇਂ ਹੀ ਜ਼ਿਆਦਾ ਦੌੜਨਾ ਚਾਹੀਦਾ ਹੈ ਕਿਉਂਕਿ ਸਵੇਰ ਦਾ ਸਮਾਂ ਲਗਭਗ ਸਭ ਤੋਂ ਸਹੀ ਹੁੰਦਾ ਹੈ ਦੌੜਨ ਦਾ ਉਸ ਸਮੇਂ ਸਾਡੇ ਸਰੀਰ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੁੰਦਾ ਹੈ ਅਤੇ ਸਾਨੂੰ ਬਿਮਾਰੀਆਂ ਵੀ ਘੱਟ ਲੱਗਦੀਆਂ ਹਨ ਅਤੇ ਜਿਸ ਕਰਕੇ ਸਾਨੂੰ ਹਮੇਸ਼ਾਂ ਹੀ ਦੌੜਨਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਸਾਨੂੰ ਸ ਦੌੜਦੇ ਰਹਿਣਾ ਚਾਹੀਦਾ ਹੈ ਇਸ ਕਰਕੇ ਸਾਡਾ ਸਰੀਰ ਤੰਦਰੁਸਤ ਬਣਿਆ ਰਹੇ